ਸਤਿ ਸ਼੍ਰੀ ਅਕਾਲ ਮੇਰਾ ਨਾਮ ਕੋਮਲ ਹੈ ਅਤੇ ਮੈਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਸਟੇਸ਼ਨ 'ਤੇ ਜਾਣ ਦੇ ਲਈ ਇੱਕ ਕੈਬ ਬੁੱਕ ਕੀਤੀ ਸੀਗੀ ਅਤੇ ਉਹ ਕੈਬ ਡਰਾਈਵਰ ਦੇ ਨਾਲ ਮੇਰੀ ਵਿਸਤਾਰਪੂਰਵਕ ਗੱਲ ਹੋਈ ਸੀਗੀ ਕਿ ਉਹ ਸਵੇਰੇ ਸੱਤ ਵਜੇ ਮੇਰੇ ਘਰ ਦੇ ਬਾਹਰ ਆ ਜਾਓ ਉਹ ਨਹੀਂ ਆਇਆ ਉਹਦੇ ਨਾ ਆਉਣ ਦਾ ਕਾਰਨ ਮੈਨੂੰ ਨਹੀਂ ਪਤਾ ਕਿ ਉਹਦੇ ਲੇਟ ਆਉਣ ਕਰਕੇ ਮੇਰੀ ਟ੍ਰੇਨ ਵੀ ਲੰਘ ਚੁੱਕੀ ਸੀਗੀ ਵੀ ਜਿਹੜੀ ਕਿ ਟ੍ਰੇਨ ਸਵੇਰੇ ਦਸ ਵਜੇ ਦੀ ਸੀਗੀ ਅਤੇ ਮੈਂ ਉਹਨੂੰ ਬੋਲਿਆ ਸੀ ਕਿ ਉਹ ਟਾਈਮ ਸਿਰ ਆ ਜਾਵੇ ਕਿਉਂਕਿ ਮੈਨੂੰ ਜ਼ਰੂਰੀ ਕੰਮ 'ਤੇ ਜਾਣਾ ਸੀਗਾ ਉਹਦੇ ਨਾ ਆਉਣ ਕਰਕੇ ਮੇਰਾ ਇੱਕ ਤਾਂ ਮੇਰਾ ਕੰਮ ਵੀ ਰੁਕ ਗਿਆ ਅਤੇ ਦੂਸਰਾ ਮੇਰੀ ਟ੍ਰੇਨ ਵੀ ਨਿਕਲ ਗਈ ਅਤੇ ਇਹ ਮੈਂ ਉਹਨੂੰ ਸਾਰੀ ਔਨਲਾਈਨ ਪੇਮੈਂਟ ਕਰ ਚੁੱਕੀ ਸੀਗੀ ਜਿੰਨੇ ਵੀ ਉਹਦੀ ਪੈਸੇ ਸੀਗੇ ਮੈਂ ਉਹਨੂੰ ਔਨਲਾਈਨ ਪੇਮੈਂਟ ਕਰ ਦਿੱਤੇ ਸੀਗੇ ਅਤੇ ਮੇਰੀ ਇਹ ਬੇਨਤੀ ਹੈ ਕਿ ਉਸ ਕੈਬ ਡਰਾਈਵਰ ਦੇ ਵਿਰੁੱਧ ਇੱਕ ਕਾ ਸਖ਼ਤ ਕਾਰਵਾਈ ਕੀਤੀ ਜਾਵੇੇ ਕਿ ਉਹ ਕਿਉਂ ਨਹੀਂ ਆਇਆ ਉਹਦੇ ਨਾ ਆਉਣ ਦਾ ਕਾਰਨ ਵੀ ਉਹਨੂੰ ਪੁੱਛਿਆ ਜਾਵੇ ਅਤੇ ਜਿਹੜੇ ਮੇਰੇ ਬਾਕੀ ਪੈਸੇ ਨੇ ਉਹ ਮੈਨੂੰ ਵਾਪਸ ਦਿੱਤੇ ਜਾਣ ਧੰਨਵਾਦ